ਹਾਂ ਮੈਂ ਕਈ ਵਾਰੀ ਪਰਦਰਸ਼ਨੀ ਮੈਂ ਕੀਤੀ ਹੈ ਮੈਂ ਕਿਉਂਕਿ ਕਾਫੀ ਵਾਰ ਫੋਟੋਆਂ ਜਿਹੜੀਆਂ ਖਿੱਚਦਾ ਨੇਚਰ 'ਤੇ ਖਿੱਚਦਾ ਹਾਂ ਜਿੱਦਾਂ ਜਾਨਵਰਾਂ ਦੀਆਂ ਹੋ ਗਈਆਂ ਪੱਕਸ਼ੀਆਂ ਦੀਆਂ ਹੋ ਗਈਆਂ ਪਹਾੜਾਂ ਦੀਆਂ ਹੋ ਗਈਆਂ ਇਹ ਫੋਟੋਆਂ ਦੀ ਮੇਰੀ ਐਗਜ਼ੀਬੀਸ਼ਨ ਬਹੁਤ ਲੱਗ ਚੁੱਕੀ ਹੈ ਅਤੇ ਇਹ ਫੋਟੋਆਂ ਵੀ ਵਧੀਆ ਲੱਗਦੀਆਂ ਹਨ ਲੋਕਾਂ ਨੇ ਵੀ ਕਾਫੀ ਹੱਦ ਤੱਕ ਪਸੰਦ ਕੀਤੀਆਂ ਹਨ ਮੈਂ ਜ਼ਿਆਦਾ ਆਪਣੀ ਐਗਜ਼ੀਬੀਸ਼ਨ ਜਿਹੜੀ ਲਗਾਈ ਹੈ ਉਹ ਅੰਮ੍ਰਿਤਸਰ ਆਰਟ ਗੈਲਰੀ 'ਚ ਲਗਾਈ ਹੈ ਉੱਥੋਂ ਦਾ ਤਜਰਬਾ ਵੀ ਮੇਰਾ ਬਹੁਤ ਵਧੀਆ ਰਿਹਾ ਹੈ